ਹਾਂਜੀ ਮੈਂ ਬੀਮਾ ਏਜੰਟਾਂ ਨਾਲ਼ ਗੱਲਬਾਤ ਕੀਤੀ ਹੈ ਐਲ ਆਈ ਸੀ ਲਾਈਫ ਇੰਸ਼ੋਰੈਂਸ ਕੰਪਨੀ ਇਹ ਵੀ ਇੱਕ ਐਸੀ ਕੰਪਨੀ ਹੈ ਜੋ ਇੰਸ਼ੋਰੈਂਸ ਕਰਦੀ ਹੈ ਪਰ ਇਸਦੇ ਵਿੱਚ ਇਹ ਇਹ ਐਸੀ ਇੰਸ਼ੋਰੈਂਸ ਕੰਪਨੀ ਹੈ ਜੋ ਕਿਸੇ ਵੀ ਬੰਦੇ ਦੇ ਲਾਈਫ ਨੂੰ ਕਿਸੇ ਦੀ ਕਿਸੇ ਵੀ ਬੰਦੇ ਦੀ ਜ਼ਿੰਦਗੀ ਨਾਲ਼ ਰਿਲੇਟਡ ਰਿਸਕ ਨੂੰ ਕਵਰ ਕਰਦੀ ਹੈ ਪਰ ਇਸ ਤੋਂ ਜ਼ਿਆਦਾ ਵਧੀਆ ਮੈਨੂੰ ਪੋਸਟਲ ਲਾਈਫ ਇੰਸ਼ੋਰੈਂਸ ਲੱਗੀ ਹੈ ਇਹ ਡਾਕ ਡਾਕਖਾਨੇ ਦੇ ਵਿੱਚ ਹੁੰਦੀ ਹੈ ਅਤੇ ਇਸਦਾ ਇੰਟਰਸਟ ਜੋ ਹੈ ਇਸਦਾ ਵਿਆਜ ਦਰ ਵੀ ਇਸਦੀ ਜ਼ਿਆਦਾ ਹੈ ਅਤੇ ਇਹ ਇਸ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜਿਸਦੀ ਜਿਸ ਕਰਕੇ ਤੁਹਾਡੇ ਪੈਸੇ ਇਸਦੇ ਵਿੱਚ ਸਾਡੇ ਪੈਸੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਰਿਸਕ ਨਹੀਂ ਹੈ ਅਤੇ ਸਾਡਾ ਪੈਸਾ ਇਸ ਦੇ ਨਾਲ ਬਿਲਕੁਲ ਹੀ ਜ਼ਿਆਦਾ